ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਸਰ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਕਿੱਦਾਂ ਤੁਸੀਂ ਫ਼ੋਨ ਕੀਤਾ ਕੀ ਗੱਲ ਹੋ ਗਈ

ਮੈਂ ਤਾਂ ਸਰ ਅੱਛੀ ਤਰ੍ਹਾਂ ਕੰਮ ਕਰਦੀ ਹਾਂ ਮੈਂ ਤਾਂ ਅੱਛੀ ਤਰ੍ਹਾਂ ਕੰਮ ਕਰਦੀ ਹਾਂ ਉਹ ਮੈਂ ਤੁਸੀਂ ਜਿੱਦਾਂ ਕਹਿੰਦੇ ਹੋ ਮੈਂ ਉੱਦਾਂ ਹੀ ਕੰਮ ਕਰਦੀ ਹਾਂ ਦੱਸੋ ਜਿੱਥੇ ਜਿੱਥੇ ਤੁਸੀਂ ਕਹਿੰਦੇ ਮੈਂ ਉੱਥੇ ਸਫ਼ਾਈ ਕਰਦੀ ਹਾਂ ਮੈਂ ਤਾਂ ਕਰਦੀ ਰਹਿੰਦੀ ਹਾਂ ਮੈਂ ਨਹੀਂ ਚਲੋਂ ਮੈਂ ਕੱਲ੍ਹ ਆਵਾਂਗੀ ਫੇਰ ਮੈਂ ਦੇਖ ਲਵਾਂਗੀ ਸਫ਼ਾਈ ਰੱਖਦੀ ਹਾਂ ਨਹੀਂ ਅੱਗੇ ਤੋਂ ਮੈਂ ਠੀਕ ਕਰਾਂਗੀ ਕੀ ਕਹਿੰਦੇ ਜਿੱਦਾਂ ਤੁਸੀਂ ਕਹੋਗੇ ਉੱਦਾਂ ਹੀ ਕਰਾਂਗੀ ਨਹੀਂ ਨਹੀਂ ਮੈਂ ਸੁਧਰ ਜਾਵਾਂਗੀ ਸੁਧਰ ਜਾਵਾਂਗੀ ਮੈਂ